ਪਹਿਲਾਂ ਪੰਜਾਬੀ ਭਾਸ਼ਾ ਨੂੰ ਬਹੁਤ ਮਿੱਠੀ ਅਤੇ ਚੰਗੀ ਸਮਝਿਆ ਜਾਂਦਾ ਸੀ ਕਿਉਂਕਿ ਹਰ ਕੋਈ ਇੱਕ ਦੂਜੇ ਦੀ ਰਿਸਪੈਕਟ ਕਰਦਾ ਸੀ ਪੈਰੀਂ ਹੱਥ ਲਾਉਂਦਾ ਸੀਗਾ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਸੀ ਕਿਤੇ ਵੀ ਕੋਈ ਭਾਸ਼ਣ ਹੁੰਦਾ ਸੀਗਾ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਲੱਗਦਾ ਸੀ ਪਰ ਅੱਜ ਕੱਲ੍ਹ ਪੰਜਾਬ ਖਾਸ ਕਰਕੇ ਪੰਜਾਬ ਵਿੱਚ ਪੰਜਾਬੀ ਨਾਲੋਂ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਪੰਜਾਬੀ ਲੋਕ ਪੰਜਾਬ ਵਿੱਚ ਰਹਿਣ ਨਾਲੋਂ ਬਾਹਰ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਜੋ ਸਕੂਲ ਨੇ ਉਹਨਾਂ ਵਿੱਚ ਅੰਗਰੇਜ਼ੀ ਜ਼ਿਆਦਾ ਪੜ੍ਹਾਈ ਜਾਂਦੀ ਹੈ ਤੇ ਕਈ ਇੱਦਾਂ ਦੇ ਸਕੂਲ ਨੇ ਜਿਨ੍ਹਾਂ ਵਿੱਚ ਪੰਜਾਬੀ ਬੈਨ ਏ ਹੈ ਬੋਲਣੀ ਵੀ ਵੀ ਬੰਦ ਕੀਤੀ ਹੋਈ ਹੈ ਜੇ ਕੋਈ ਬੋਲਦਾ ਤਾਂ ਉਨਸ ਉਸ ਦੇ ਜੁਰਮਾਨਾ ਲੱਗਦਾ ਹੈ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਉਹਨਾਂ ਵਿੱਚ ਹਿੰਦੀ ਬੋਲੀ ਜਾਂਦੀ ਹੈ ਪਰ ਪੇਂਡੂ ਖੇਤਰਾਂ ਵਿੱਚ ਅਜੇ ਵੀ ਪੰਜਾਬੀ ਬੋਲੀ ਜਾਂਦੀ ਹੈ ਬਟ ਉਹਦੇ ਇਸ ਦੇ ਵਿੱਚ ਵੀ ਹਿੰਦੀ ਮਿਕਸ ਹੋ ਗਈ ਬਾਕੀ ਅੱਜ ਕੱਲ੍ਹ ਦੇ ਜੋ ਪੰਜਾਬੀ ਗੀਤ ਨੇ ਉਨ੍ਹਾਂ ਕਰਕੇ ਪੰਜਾਬੀ ਦੀ ਅਹਿਮੀਅਤ ਦੇਸ਼ਾਂ ਵਿਦੇਸ਼ਾਂ ਵਿੱਚ ਕਾਫੀ ਵੱਧ ਗਈ ਹੈ ਪਰ ਪੰਜਾਬੀ ਦੀ ਅਹਿਮੀਅਤ ਪੰਜਾਬ ਵਿੱਚ ਘੱਟਦੀ ਜਾ ਰਹੀ ਹੈ